ਜਿਹੜੀ ਫੋਟੋਗ੍ਰਾਫੀ ਆ ਇਹ ਪੁਰਾਣੇ ਸਮਿਆਂ ਨਾਲੋਂ ਹੁਣ ਦੇ ਸਮੇਂ ਵਿੱਚ ਕਾਫੀ ਬਦਲ ਚੁੱਕੀ ਆ ਜਿਸ ਤਰ੍ਹਾਂ ਅੱਗੇ ਫੋ ਕੈਮਰੇ ਚੱਕ ਕੇ ਲੈ ਜਾਣੇ ਪੈਂਦੇ ਸੀਗੇ ਉਹਨਾਂ ਨਾਲ ਬਲੈਕ ਡਿਵੈਟ ਫੋਟੋ ਆਉਂਦੀ ਸੀ ਹੁਣ ਕਲਰ ਵਾਲੀ ਆਉਂਦੀ ਆ ਹੁਣ ਕੈਮਰਿਆਂ ਦਾ ਵੀ ਜਿਸ ਤਰ੍ਹਾਂ ਕੋਈ ਪਿਕਨਿਕ ਵਗੈਰਾ 'ਤੇ ਜਾਂਦਾ ਘੁੰਮਣ ਜਾਂਦਾ ਕੈਮਰੇ ਕੋਈ ਚੱਕ ਕੇ ਨਹੀਂ ਲੈ ਕੇ ਜਾਂਦਾ ਫੋਨ ਲੈ ਕੇ ਜਾਂਦਾ ਫੋਨਾਂ ਨਾਲ ਫੋਟੋਆਂ ਖਿੱਚ ਲੈਂਦਾ ਅਗਲਾ ਪਹਿਲਾਂ ਪੁਰਾਣੀਆਂ ਤਕਨੀਕਾਂ ਹੋਰ ਸੀ ਹੁਣ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਹੁਣ ਕਲਰ ਵਾਲੀਆਂ ਫੋਟੋਆਂ ਆਂਗ ਆ ਗਈਆਂ ਪਹਿਲਾਂ ਪਰਾਕਾ ਬਲੈਕ ਐਂਡ ਵੈਟ ਆਉਂਦੀਆਂ ਸੀ ਇਸ ਤਰ੍ਹਾਂ ਵੀ ਇਹ ਜਿਹੜੇ ਫੋਟੋਆਂ ਦਾ ਕਾਫੀ ਕੰਮ ਮਤਲਬ ਸੌਖਾ ਹੋ ਗਿਆ ਲੋਕਾਂ ਨੂੰ ਅਗਲਾ ਫੋਨ 'ਤੇ ਹੀ ਖਿੱਚ ਲੈਂਦਾ ਕੈਮਰਿਆਂ ਦਾ ਸਾਰਾ ਕੰਮ ਬਦਲ ਗਿਆ ਹੁਣ ਇੱਦਾਂ ਵੀ ਤਕਨੀਕ ਆ ਐਡਿਡ ਕਰ ਲੈਂਦੇ ਨੇ ਫੋਟੋਆਂ ਅਗਲੇ ਹੁਣ ਬ ਪਹਿਲਾਂ ਮ ਹੋਰ ਸੀ ਤਕਨੀਕਾਂ ਹੁਣ ਨਵੀਆਂ ਨਵੀਆਂ ਤਕਨੀਕਾਂ ਹੋ ਗਈਆਂ ਇਸ ਤਰ੍ਹਾਂ ਜਿਉਂ ਜਿਉਂ ਸਾਇੰਸ ਨੇ ਤਰੱਕੀ ਕਰ ਲਈ ਤਿਉਂ ਤਿਉਂ ਸਾਰਾ ਫੋਟੋਗ੍ਰੈਫੀ ਵਗੈਰਾ ਦਾ ਸਾਰਾ ਹੀ ਕੰਮ ਬਦਲ ਗਿਆ ਹੁਣ